ਸਤਿ ਸ਼੍ਰੀ ਅਕਾਲ ਜੀ ਆਪ ਜੀ ਨੇ ਪੁੱਛਿਆ ਹੈ ਪੇਂਡੂ ਲੋਕਾਂ ਲਈ ਕਾਨੂੰਨੀ ਸੇਵਾਵਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਹਾਂ ਸਾਨੂੰ ਸਰਕਾਰੀ ਕੰਮਾਂ ਵਿੱਚ ਜੇਕਰ ਪੈਣਾ ਪਵੇ ਤਾਂ ਪਿੰਡਾਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਕਿਉਂਕਿ ਵਕੀਲ ਜੋ ਹੁੰਦੇ ਹਨ ਪਿੰਡਾਂ ਵਾਲੇ ਲੋਕਾਂ ਨੂੰ ਦੇਖ ਕੇ ਪਹਿਲਾਂ ਹੀ ਕਿਉਂਕਿ ਪਿੰਡਾਂ ਵਾਲੇ ਲੋਕ ਜੋ ਬਜ਼ੁਰਗ ਪੀੜ੍ਹੀ ਹੈ ਜਾਂ ਪਿੰਡਾਂ ਵਾਲੇ ਲੋਕ ਹਨ ਘੱਟ ਪੜ੍ਹੇ ਲਿਖੇ ਹੋਣ ਕਰਕੇ ਇਹ ਉਹਨਾਂ ਨੂੰ ਇਸ ਤਰ੍ਹਾਂ ਡੀਲ ਕਰਦੇ ਹਨ ਕਿਉਂਕਿ ਉਹ ਘੱਟ ਪਟੇ ਪੜ੍ਹੇ ਲਿਖੇ ਹੁੰਦੇ ਹਨ ਉਹਨਾਂ ਨੂੰ ਕਾਨੂੰਨ ਬਾਰੇ ਸੰਵਿਧਾਨ ਬਾਰੇ ਜ਼ਿਆਦਾ ਕੁਝ ਨਹੀਂ ਪਤਾ ਹੁੰਦਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜੋ ਵੀ ਵਕੀਲ ਕਹਿ ਦੇਣ ਉਹ ਫੀਸਾਂ ਦੇਣੀਆਂ ਪੈਂਦੀਆਂ ਹਨ ਅਤੇ ਇਸਦਾ ਅਨੁਭਵ ਇਹ ਹੈ ਵਕੀਲਾਂ ਦੇ ਰਸਤੇ ਜੋ ਵੀ ਪੈਂਦਾ ਹੈ ਪਿੰਡਾਂ ਵਾਲੇ ਲੋਕਾਂ ਨੂੰ ਇਸਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਦੇ ਵਿੱਚ ਜੇਕਰ ਪਿੰਡਾਂ ਵਾਲੇ ਲੋਕ ਜਾਂਦੇ ਹਨ ਜ਼ਿਆਦਾਤਰ ਪੁਲੀਸ ਵਾਲੇ ਹਨ ਇਹ ਨਹੀਂ ਹੈਗਾ ਵੀ ਸਾਰੇ ਜੋ ਪੁਲੀਸ ਵਾਲੇ ਹਨ ਉਹ ਰਿਸ਼ਵਤਖੋਰ ਹੀ ਹਨ ਪਰ ਕੁਛ ਬੰਦੇ ਵਿੱਚ ਕੁਛ ਮੁਲਾਜ਼ਮ ਵਿੱਚ ਇਮਾਨਦਾਰ ਵੀ ਹੁੰਦੇ ਹਨ ਅਤੇ ਜ਼ਿਆਦਾਤਰ ਪੰਜਾਹ ਪ੍ਰਸੈਂਟ ਪੁਲਿਸ ਵਾਲੇ ਰਿਸ਼ਵਤਖੋਰੀ ਜੇਕਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਕੰਮ ਹੈ ਵੀ ਸਾਨੂੰ ਇੰਨੇ ਪੈਸੇ ਦਓ ਤਾਂ ਅਸੀਂ ਇਹ ਕੰਮ ਇੱਦਾਂ ਹੋ ਜਾਵੇਗਾ ਅਤੇ ਜੇਕਰ ਉਹਨਾਂ ਨਾਲ ਕੋਈ ਗੱਲ ਕੀਤੀ ਜਾਵੇ ਤਾਂ ਉਹ ਅਫਸਰਾਂ ਦਾ ਨਾਮ ਲੈਂਦੇ ਹਨ ਪਰ ਪਿੰਡਾਂ ਵਾਲੇ ਲੋਕ ਲੜਾਈਆਂ ਝਗੜਿਆਂ ਦੇ ਵਿੱਚ ਜ਼ਿਆਦਾ ਪੈਣ ਕਰਕੇ ਪੁਲਿਸ ਦੇ ਧੱਕੇ ਜ਼ਿਆਦਾ ਚੜਦੇ ਹਨ ਅਤੇ ਤੀਜਾ ਨੰਬਰ ਅਦਾਲਤਾਂ ਜੇਕਰ ਅਦਾਲਤਾਂ ਦੇ ਰਾਹ ਪਿੰਡਾਂ ਵਾਲੇ ਲੋਕ ਪੈਂਦੇ ਹਨ ਕਿਉਂਕਿ ਘੱਟ ਪੜ੍ਹੇ ਹੋਣ ਕਰਕੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਜ਼ਮੀਨਾਂ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਅਤੇ ਅਦਾਲਤਾਂ ਦੇ ਵਿੱਚ ਜ਼ਿਆਦਾਤਰ ਕੇਸ ਪਿੰਡਾਂ ਵਾਲਿਆਂ ਦੇ ਚਲਦੇ ਹਨ ਪਿੰਡਾਂ ਵਾਲੇ ਲੋਕ ਪਿੰਡਾਂ ਦੇ ਵਿੱਚ ਸਮਝੌਤਾ ਨਾ ਕਰਕੇ ਇਹ ਇਹਨਾਂ ਅਦਾਲਤ ਵਕੀਲਾਂ ਦੇ ਅਤੇ ਪੁਲੀਸ ਦੇ ਰਾਹੀਂ ਪਹਿਲਾਂ ਪੁਲੀਸ ਫਿਰ ਵਕੀਲ ਫਿਰ ਅਦਾਲਤਾਂ ਦੇ ਰਾਹੀਂ ਇਹ ਜਾ ਕੇ ਆਪਣਾ ਪੈਸਾ ਲੁਟਾਉਂਦੇ ਹਨ ਪਰ ਇਸਦਾ ਕੋਈ ਨਾ ਕੋਈ ਥੱਲੇ ਅਦਾਲਤਾਂ ਦੇ ਰਾਹੀਂ ਕੋਈ ਨਾ ਕੋਈ ਸਮਝੌਤਾ ਹੋਣਾ ਚਾਹੀਦਾ ਹੈ ਅਤੇ ਸੇਵਾਵਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ